ਮੈਂ ਵਿਲੇਜ ਤੋਂ ਬਿਲੋਂਗ ਕਰਦੀ ਹਾਂ ਜਿ ਜਿਹਦੇ ਵਿੱਚ ਕਿ ਨਾਲ ਹੀ ਮਤਲਬ ਇੱਕ ਸਟੇਡੀਅਮ ਦੀ ਫੈਸਿਲਿਟੀਜ਼ ਆ ਜਿਹਦੇ ਵਿੱਚ ਕਿ ਸਟੇਡੀਅਮ ਦੇ ਨਾਲ ਨਾਲ ਹੋਰ ਵੀ ਬਾਕੀ ਬਹੁਤ ਸਾਰੀਆਂ ਫੈਸਿਲਿਟੀਜ਼ ਹਨ ਲਾਈਕ ਗਰਾਊਂਡ ਦੇ ਪੂਰਾ ਮਤਲਬ ਗਰਾਊਂਡ ਕਰਨ ਵਾਸਤੇ ਜਿੱਥੇ ਮਤਲਬ ਕਰ ਸਕਦੇ ਹਨ ਪਲੇ ਕਰ ਸਕਦੇ ਹਨ ਬੱਚੇ ਖੇਡ ਸਕਦੇ ਹਨ ਰਨਿੰਗ ਕਰ ਸਕਦੇ ਹਨ ਅਤੇ ਉਸਦੇ ਵਿੱਚ ਮਤਲਬ ਪਾਣੀ ਦੀ ਫੈਸਿਲਿਟੀਜ਼ ਹੈ ਤਾਂ ਕਿ ਕਿ ਕਿਸੇ ਨੂੰ ਵੀ ਕਿਸੇ ਐਨੀ ਟਾਈਮ ਅਗਰ ਕਿਸੇ ਨੂੰ ਵੀ ਕੁਛ ਵੀ ਜਾਂ ਕਿਵੇਂ ਵੀ ਆਪਣਾ ਕੋਈ ਨਾ ਫੈਸਿਲਿਟੀਜ਼ ਲੈ ਕੇ ਮਤਲਬ ਘਰ ਤੋਂ ਨਾ ਲੈ ਕੇ ਆਇਆ ਹੋਵੇ ਤਾਂ ਉੱਥੇ ਪਾਣੀ ਦੀ ਫੈਸਿਲਿਟੀਜ਼ ਹੈ ਉਹ ਨਾਲ ਹੀ ਅਗਰ ਜਿਵੇਂ ਸਡਨਲੀ ਅਗਰ ਕਿਸੇ ਨੂੰ ਕੁਛ ਹੋ ਜਵੇ ਜਾਂ ਅਚਾਨਕਲੀ ਮਤਲਬ ਜਿਵੇਂ ਕੁਛ ਵੀ ਮਤਲਬ ਦੁਰਘਟਨਾ ਹੋ ਜਵੇ ਉਹਦੇ ਲਈ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਨਾਲ ਕੀਤੀ ਗਈ ਹੈ ਔਲਮੋਸਟ ਮਤਲਬ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਗਈਆਂ ਹਨ ਜਿਹਦੇ ਨਾਲ ਕਿ ਸਟੇਡੀਅਮ ਦੀ ਸਟੇਡੀਅਮ ਵਿੱਚ ਬੱਚੇ ਆਉਣ ਅਤੇ ਆਪਣੇ ਆਪ ਨੂੰ ਥੋੜ੍ਹਾ ਅਪ ਅਪ ਕਹਿ ਸਕਣ ਓਕੇ ਥੈਂਕ ਯੂ